ਕੁਝ ਇਸ ਤਰ੍ਹਾਂ ਦੇ ਵਹਿਮ ਭਰਮ ਭਰਮ ਹੁੰਦੇ ਹਨ ਜਿਨ੍ਹਾਂ 'ਤੇ ਲੋਕ ਬੜੀ ਮਜ਼ਬੂਤੀ ਨਾਲ ਵਿਸ਼ਵਾਸ ਕਰਦੇ ਹਨ ਜਿਵੇਂ ਕਿ ਅੱਜ ਕੱਲ੍ਹ ਲੋਕ ਵਹਿਮਾਂ ਭਰਮਾਂ 'ਤੇ ਬਹੁਤ ਵਿਸ਼ਵਾਸ ਰੱਖਦੇ ਹਨ ਜਿਵੇਂ ਕਿ ਬਿੱਲੀ ਦਾ ਰਾਹ ਕੱਟ ਜਾਣਾ ਵੀਰਵਾਰ ਨੂੰ ਕੱਪੜੇ ਨਾ ਧੋਣਾ ਸ਼ਨੀਵਾਰ ਨੂੰ ਨਾ ਨਹਾਉਣਾ ਘਰ ਆਏ ਜਵਾਈ ਨੂੰ ਦੁੱਧ ਨਾ ਪਿਆ ਕੇ ਤੋਰਨਾ ਘਰ ਜਾ ਘਰੋਂ ਜਾਂਦੇ ਇਨਸਾਨ ਨੂੰ ਪਿੱਛੋਂ ਅਵਾਜ਼ ਲਗਾਉਣੀ ਛਿੱਕ ਮਾਰਨੀ ਛਿੱਕ ਮਾਰਨੀ ਅਤੇ ਅੱਖ ਫੜਕਣੀ ਮਹਿੰਦੀ ਲਾ ਕੇ ਬਾਹਰ ਨਾ ਜਾਣਾ ਪਰਫਿਊਮ ਲਾ ਕੇ ਬਾਹਰ ਨਾ ਜਾਣਾ ਅਤੇ ਬਿਲ ਕਾਲੀ ਬਿੱਲੀ ਦਾ ਰਾਹ ਕੱਟ ਜਾਣਾ